ਅਸੀਂ ਫੁੱਲ ਫਲ਼ ਅਤੇ ਸਬਜ਼ੀਆਂ ਤਿੰਨੋਂ ਕਿਸਮਾਂ ਦੇ ਪੌਦੇ ਉਗਾਉਣਾ ਪਸੰਦ ਕਰਦੇ ਹਾਂ ਜਿਵੇਂ ਕਿ ਦੇਖਿਆ ਜਾਵੇ ਫੁ ਫੁੱਲਾਂ ਦੀ ਵਰਤੋਂ ਸਾਡੀ ਬਜ਼ੀ ਬਗੀਚੀ ਲਈ ਸਜਾਵਟ ਲਈ ਵਰਤੀ ਜਾਂਦੀ ਹੈ ਫੁੱਲ ਆਪਣੇ ਬਗੀਚੇ ਵਿੱਚ ਲੱਗੇ ਹੋਣ ਵੱਖ ਵੱਖ ਕਿਸਮਾਂ ਦੇ ਫੁੱਲ ਲੱਗੇ ਹੋਣ ਬਹੁਤ ਸੋਹਣੇ ਲੱਗਦੇ ਹਨ ਬਗੀਚੇ ਵਿੱਚ ਬੈਠ ਕੇ ਜੀਅ ਲੱਗਦਾ ਹੈ ਅਤੇ ਫਲ਼ ਫਲ਼ਾਂ ਤੋਂ ਸਾਨੂੰ ਆਪਣੇ ਮਿਨਰਲਸ ਮਿਲਦੇ ਹਨ ਸ ਅਸੀਂ ਅਲੇ ਅਲੱਗ ਅਲੱਗ ਤਰ੍ਹਾਂ ਦੇ ਅਗਰ ਫਲ਼ ਖਾਂਦੇ ਹਾਂ ਤਾਂ ਸਾਨੂੰ ਉਹਨਾਂ ਤੋਂ ਅਲੱਗ ਅਲੱਗ ਤਰ੍ਹਾਂ ਦੇ ਮਿਨਰਲ ਮਿਲਦੇ ਹਨ ਅਤੇ ਸਬਜ਼ੀਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਆਪਾਂ ਨੂੰ ਬਾਹਰੋਂ ਅਗਰ ਸਬਜ਼ੀ ਖਰੀਦਦੇ ਹਾਂ ਤਾਂ ਸਾਨੂੰ ਰੇਹ ਸਪਰੇਅ ਵਾਲ਼ੀ ਸਬਜ਼ੀ ਮਿਲਦੀ ਹੈ ਅਗਰ ਆਪਾਂ ਘਰਾਂ ਆਪਣੀ ਖੁਦ ਦੀ ਸਬਜ਼ੀ ਤਿਆਰ ਕਰਕੇ ਖਾਂਦੇ ਹਾਂ ਤਾਂ ਉਸ ਤੋਂ ਆਪਾਂ ਨੂੰ ਰੇਹ ਸਪਰੇਅ ਤੋਂ ਬਚਾ ਮਿਲਦਾ ਹੈ ਅਤੇ ਦੂਜੀ ਗੱਲ ਇਨ ਇਹਨਾਂ ਤੋਂ ਸਾਨੂੰ ਵਿਟਾਮਿਨ ਦੀ ਘਾਟ ਜਿਹੜੀ ਸਬਜ਼ੀਆਂ ਤੋਂ ਪੂਰੀ ਹੁੰਦੀ ਹੈ ਇਸ ਲਈ ਅਸੀਂ ਨਾ ਤਿੰਨੋਂ ਕਿਸਮਾਂ ਦੇ ਚੀਜ਼ਾਂ ਫਲ਼ ਫੁੱਲ ਅਤੇ ਸਬਜ਼ੀਆਂ ਤਿੰਨੋਂ ਉਗਾਉਣੇ ਪਸੰਦ ਕਰਾਂਗੇ